ਪੰਜਾਬ 'ਚ ਕਈ ਤਰ੍ਹਾਂ ਦੇ ਧਰਮ ਹਨ ਜਿੱਦਾਂ ਕਿ ਪੰਜਾਬ ਦਾ ਜਿਹੜਾ ਮੁੱਖ ਧਰਮ ਹੈਗਾ ਉਹ ਹੈਗਾ ਸਿੱਖ ਕਿਉਂਕਿ ਇੱਥੇ ਜ਼ਿਆਦਾ ਅਬਾਦੀ ਸਿੱਖਾਂ ਦੀ ਹੈ ਅਤੇ ਉਸ ਤੋਂ ਬਾਅਦ ਆਉਂਦਾ ਹਿੰਦੂ ਅਤੇ ਫਿਰ ਆਉਂਦਾ ਅੱਜ ਕੱਲ੍ਹ ਕ੍ਰਿਸਚਨ ਉਸ ਤੋਂ ਬਾਅਦ ਆਉਂਦੇ ਨੇ ਮੁਸਲਮਾਨ ਅਤੇ ਪੰਜਾਬ 'ਚ ਸਾਰੇ ਧਰਮਾਂ ਤਰ੍ਹਾਂ ਦੇ ਲੋਕ ਰਹਿੰਦੇ ਨੇ ਇੱਥੇ ਜੈਨ ਲੋਕ ਬਹੁਤ ਲੋਕ ਤੁਹਾਨੂੰ ਘੱਟ ਗਿਣਤੀ 'ਚ ਮਿਲਣਗੇ ਪਰ ਮਿਲ ਜਾਣਗੇ ਅਤੇ ਜਿਹੜਾ ਪੰਜਾਬ ਦਾ ਜਿਹੜਾ ਮੇਨ ਗ੍ਰੰਥ ਹੈਗਾ ਉਹ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂਕਿ ਹਰ ਪੰਜਾਬੀ ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ ਚਾਹੇ ਉਹ ਕ੍ਰਿਸਚਨ ਹੋਵੇ ਚਾਹੇ ਉਹ ਜੈਨ ਹੋਵੇ ਬੋਧ ਹੋਵੇ ਅਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਉਂਦਾ ਹੈ ਅਤੇ ਜਿਹੜੇ ਮੇਨ ਹੈ ਸਿੱਖ ਅਤੇ ਹਿੰਦੂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਆਪਣਾ ਅ ਮੰਨਦੇ ਨੇ ਕਿਉਂਕਿ ਇਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਸ ਗੁਰੂਆਂ ਦੀ ਜਿਹੜੀ ਬਾਣੀ ਦੇ ਨਾਲ ਨਾਲ ਹਿੰਦੂ ਧਰਮ ਦੇ ਜਿੰਨੇ ਵੀ ਦੇਵੀ ਦੇਵਤਾ ਹੋਏ ਨੇ ਚਾਹੇ ਸ਼੍ਰੀ ਕ੍ਰਿਸ਼ਨ ਜੀ ਨੇ ਚਾਹੇ ਭਗਵਾਨ ਰਾਮ ਨੇ ਚਾਹੇ ਉਹ ਸ਼ਿਵ ਨੇ ਚਾਹੇ ਉਹ ਮਾਤਾ ਕਾਲੀ ਨੇ ਕਿਉਂਕਿ ਮਾਤਾ ਕਾਲੀ ਨੇ ਅਤੇ ਜਾਂ ਹੋਰ ਜਿੰਨੇ ਵੀ ਹਿੰਦੂ ਧਰਮ ਦੇ ਦੇਵੀ ਦੇਵਤਾ ਨੇ ਉਹਨਾਂ ਬਾਰੇ ਇਸ ਵਿੱਚ ਜ਼ਿਕਰ ਕੀਤਾ ਗਿਆ ਹੈ ਜਿੱਦਾਂ ਕਿ ਆਪਾਂ ਲਾ ਲਈਏ ਚੰਡੀ ਦੀ ਵਾਰ ਚੰਡੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖੀ ਸੀ ਇਹ 'ਚ ਉਹ ਮਾਤਾ ਕਾਲੀ ਦੀ ਪੂਜਾ ਕਰਦੇ ਨੇ ਆਪਣੀ ਲੜਾਈ 'ਚ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਇਹ 'ਚ ਹੋਰ ਵੀ ਬਾਕੀ ਜਿੱਦਾਂ ਕਿ ਰਵਿਦਾਸ ਮਹਾਰਾਜ ਦੀ ਬਾਣੀ ਹੈਗੀ ਹੈ ਜਿੰਨੇ ਵੱਡੇ ਕਬੀਰ ਮਹਾਰਾਜ ਦੀ ਬਾਣੀ ਹੈ ਅਤੇ ਜਿੰਨੇ ਇਸ ਕਰਕੇ ਪੰਜਾਬ ਵਿੱਚ ਜਿੰਨੇ ਵੀ ਧ ਧਰਮ ਦੇ ਲੋਕ ਚਾਹੇ ਰਵਿਦਾਸ ਸਮਾਜ ਤੋਂ ਬਿਲੋਂਗ ਕਰਦੇ ਨੇ ਚਾਹੇ ਉਹ ਕਬੀਰ ਸਮਾਜ ਤੋਂ ਬਿਲੋਂਗ ਕਰਦੇ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਉਹ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਨੇ